ਹਾਂਜੀ ਮੇਰਾ ਨਾਂ ਗੁਰਪ੍ਰੀਤ ਆ ਅਤੇ ਮੈਂ ਖਾਣਾ ਬਣਾਉਣ ਦਾ ਥੋੜ੍ਹਾ ਸ਼ੌਂਕ ਰੱਖਦਾ ਸੋ ਖਾਣਾ ਬਣਾਉਣਾ ਸ਼ੌਂਕ ਇੱਕ ਵੱਖਰੀ ਗੱਲ ਆ ਸੋ ਕਰੀਅਰ ਦੇ ਵਿੱਚ ਲੈ ਕੇ ਆਉਣਾ ਵੱਖਰੀ ਗੱਲ ਸੋ ਮੈਂ ਜੋਬ ਦੇ ਨਾਲ ਨਾਲ ਵੈਸੇ ਘਰ ਸ਼ੌਂਕ ਰੱਖਦਾ ਖਾਣਾ ਬਣਾਉਣ ਦਾ ਅਤੇ ਖਾਣਾ ਬਣਾਉਣਾ ਜਿਵੇਂ ਮੈਨੂੰ ਬਰਗਰ ਬਣਾਉਣਾ ਵਧੀਆ ਲੱਗਦਾ ਗਾ ਨੂਡਲਸ ਵਧੀਆ ਲੱਗਦੇ ਆ ਅਤੇ ਫਸਟ ਫੂਡ ਦਾ ਜੋ ਵੀ ਸਮਾਨ ਆ ਉਹ ਮੈਂ ਤਕਰੀਬਨ ਬਣਾ ਲੈਂਦਾ ਗਾ ਪਰ ਇਸ ਵਿੱਚ ਕੁਛ ਘਰ ਰਾਇ ਕੀਤੀ ਸੀਗੀ ਮੈਂ ਅਤੇ ਘਰ ਵਿੱਚ ਪਾਪਾ ਜੀ ਕਹਿੰਦੇ ਕਹਿੰਦੇ ਵੀ ਇਹ ਕਿਤੇ ਨਾ ਕਿਤੇ ਸਿਹਤ ਨੂੰ ਖ਼ਰਾਬ ਕਰਨ ਵਾਲੀਆਂ ਵੀ ਚੀਜ਼ਾਂ ਨੇ ਜਿਵੇਂ ਕਿ ਹੁਣ ਫਾਸਟ ਫੂਡ ਦੇ ਵਿੱਚ ਤੇਲ ਦਾ ਜ਼ਿਆਦਾ ਯੂਜ ਹੁੰਦਾ ਰਿਫਾਇਡ ਦਾ ਜ਼ਿਆਦਾ ਯੂਜ ਹੁੰਦਾ ਅਤੇ ਉਹਦਾ ਕਰਕੇ ਹਾਰਟ ਦੀਆਂ ਪਰੇਸ਼ਾਨੀਆਂ ਵੀ ਬਹੁਤ ਆਉਂਦੀਆਂ ਅਤੇ ਉਹ ਜਾਨੀ ਕਿ ਸਹੀ ਨਹੀਂ ਖਾਣ ਦੇ ਵਿੱਚ ਤਾਂ ਕਰਕੇ ਮੈਂ ਇਹ ਸ਼ੌਂਕ ਰੱਖਦਾ ਗਾ ਕਹਿਣ ਦਾ ਮਤਲਬ ਖਾਣਾ ਬਣਾਉਣ ਦਾ ਜਾਂ ਇਸ ਨੂੰ ਕਰੀਅਰ ਦੇ ਵਿੱਚ ਲੈ ਕੇ ਆਉਣ ਦਾ ਕੋਈ ਇੱਦਾਂ ਦਾ ਵਿਚਾਰ ਹੈ ਨਹੀਂ ਸੀ ਵੈਸੇ ਮੇਰਾ ਅਤੇ ਜੇ ਮੈਨੂੰ ਲੱਗਦਾ ਵੀ ਖਾਣਾ ਚਾਹੀਦਾ ਗਾ ਤਾਂ ਫਰੂਟ ਖਾਣੇ ਚਾਹੀਦੇ ਆ ਜ਼ਿਆਦਾਤਰ ਖਾਣਾ ਬਣਾ ਕੇ ਟੱਚ ਚੰਗੀ ਤਰ੍ਹਾ ਖਾਣੇ ਨੂੰ ਭੁੰਨਿਆ ਹੋਣਾ ਚਾਹੀਦਾ ਚੰਗੀ ਤਰ੍ਹਾਂ ਬਣਿਆ ਹੋਣਾ ਚਾਹੀਦਾ ਗਾ ਕੱਚਾ ਨਹੀਂ ਹੋਣਾ ਚਾਹੀਦਾ ਗਾ ਤਾਂ ਕਿ ਆਪਣੀ ਸਿਹਤ ਬਿਲਕੁਲ ਠੀਕ ਰਹੇ